ਖਾਣੇ ਦੇ ਵਿੱਚ ਤੁਹਾਡੇ ਕੋਲ ਕੀ ਹੈ ਮੇਰੇ ਲਈ ਮੈਨੂੰ ਭੋਜਨ ਦੇ ਵਿੱਚ ਚਾਹੀਦਾ ਹੈ ਨਾਲ ਦਾਲ ਮੱਖਣੀ ਮਟਰ ਪਨੀਰ ਔਰ ਚਪਾਤੀ ਪਾਣੀ ਦੀ ਬੌਟਲ ਸਲਾਦ ਜੂਸ ਜੂਸ ਦੇ ਵਿੱਚ ਕੀ ਕੀ ਹੈ ਮੇਰੇ ਲਈ ਮੈਨੂੰ ਮਸੰਮੀ ਦਾ ਜੂਸ ਚਾਹੀਏ ਥੈਂਕ ਯੂ